ਦੇਖੋ ਜੀ ਗੇਮਾਂ ਤਾਂ ਬਹੁਤ ਸਾਰੀਆਂ ਪਰ ਸਭ ਤੋਂ ਮਨਪਸੰਦ ਗੇਮ ਮੇਰੀ ਹੈ ਬੈਡਮਿੰਟਨ ਚਿੜੀ ਛਿੱਕਾ ਜਿਹਨੂੰ ਕਹਿੰਦੇ ਆ ਬੈਡਮਿੰਟਨ ਇਸ ਪਿੱਛੇ ਪਸੰਦ ਆ ਕਿ ਇੱਕ ਤਾਂ ਇਹਦੇ ਵਾਸਤੇ ਮਤਲਬ ਕਿ ਜਗ੍ਹਾ ਦੀ ਕੋਈ ਇੰਨੀ ਪਾਬੰਦੀ ਨਹੀਂ ਹੁੰਦੀ ਕਿ ਅਸੀਂ ਗਲੀ 'ਚ ਵੀ ਖੇਡ ਸਕਦੇ ਹਾਂ ਛੱਤ 'ਤੇ ਵੀ ਖੇਡ ਸਕਦੇ ਹਾਂ ਅਤੇ ਪਾਰਕ 'ਤੇ ਜਾ ਕੇ ਵੀ ਖੇਡ ਸਕਦੇ ਹਾਂ ਉਹਦੇ ਨਾਲ ਕੀ ਹੈ ਕਿ ਇੱਕ ਤਾਂ ਬੋਡੀ 'ਚ ਬੜੀ ਸਟਰੈਚ ਬਣੀ ਰਹਿੰਦੀ ਹੈ ਜਦੋਂ ਅਸੀਂ ਖੇਡਦੇ ਹਾਂ ਅਤੇ ਐਕਸਰਸਾਈਜ਼ ਵੀ ਬਹੁਤ ਵਧੀਆ ਹੁੰਦੀ ਹੈ ਇਹਦੇ ਨਾਲ ਕਿਉਂਕਿ ਜੋ ਤੁਸੀਂ ਬੈਡਮਿੰਟਨ ਖੇਡਦੇ ਨੱਠ ਭੱਜ ਸਾਡੀ ਐਨੀ ਕਦੇ ਅਸੀਂ ਇੱਧਰ ਨੂੰ ਇੱਕ ਦ ਇੱਕ ਕਿਸਮ ਦੀ ਨਾ ਇਹਦੇ 'ਚ ਦੌੜ ਵੀ ਲੱਗਦੀ ਹੈ ਸਾਡੀ ਇਕੱਲੇ ਇਹ ਨਹੀਂ ਕਿ ਇੱਕ ਜਗ੍ਹਾ ਖੜੇ ਹੋ ਕੇ ਨਹੀਂ ਅਸੀਂ ਖੇਡਦੇ ਨੱਠ ਦੌੜ ਦੌੜ ਕੇ ਇਹਨੂੰ ਅਸੀਂ ਖੇਡਦੇ ਆ ਉਹਦੇ ਨਾਲ ਸਾਡਾ ਸਾਹ ਵਾਲੇ ਜਿਹੜੇ ਪ੍ਰੋਬਲਮ ਆ ਉਹ ਵੀ ਠੀਕ ਹੁੰਦੀ ਆ ਸਾਡਾ ਮਤਲਬ ਕਿ ਵਰਕਿੰਗ ਕੰਪੈਸਟੀ ਵੀ ਵੱਧਦੀ ਆ ਬੋਡੀ ਨੂੰ ਔਕਸੀ ਬਾਹਰ ਸਵੇਰੇ ਮਾਰਨਿੰਗ ਟਾਈਮ 'ਤੇ ਖੇਡਣ ਜਾਓ ਆਪਣੇ ਪਾਰਕ ਵਿੱਚ ਤਾਂ ਔਕਸੀਜਨ ਵੀ ਮਿਲਦੀ ਹੈ ਸਾਡੇ ਬੋਡੀ ਨੂੰ ਅਤੇ ਸਟਰੈਚਿੰਗ ਕਾਫ਼ੀ ਅੱਛੀ ਹੋ ਜਾਂਦੀ ਹੈ ਸਾਡੀ ਬਸ ਇਹ ਹੈ ਕਿ ਇਹਨੂੰ ਤੁਸੀਂ ਸਭ ਤੋਂ ਵੱਡੀ ਗੱਲ ਖੇਡ ਜਿੱਥੇ ਮਰਜ਼ੀ ਸਕਦੇ ਹਾਂ ਇਹਨੂੰ ਅਸੀਂ